ਪੰਜ ਜਨਵਰੀ ਉੱਨੀ ਸੌ ਪਚਾਨਵੇਂ ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਅਠਾਈ ਸਤੰਬਰ ਉੱਨੀ ਸੌ ਸੱਤ ਬਾਈ ਦਸੰਬਰ ਉੱਨੀ ਸੌ ਛਿਆਹਠ